ਹੈਲੋ ਸਤਿ ਸ਼੍ਰੀ ਅਕਾਲ ਜੀ ਮੈਂ ਅਲਫਾ ਹੋਸਪਿਟਲ ਤੋਂ ਬੋਲਦਾ ਪਿਆ ਹੈਗਾ ਮੈਨੂੰ ਕੋਵਿਡ ਨਾਈਨਟੀਨ ਦੇ ਵਾਸਤੇ ਦੋ ਤਿੰਨ ਟੀਕਿਆਂ ਦੀ ਲੋੜ ਹੈਗੀ ਹੈ ਇਹ ਟੀਕਿਆਂ ਦੇ ਲਈ ਮੋਸਿਸਟਿਕ ਟੀਕੇ ਦੀ ਸਪਲਾਈ ਅਤੇ ਰੈਲੋਗਰੈਸ ਦੀ ਜ਼ਰੂਰਤਾਂ ਪਾ ਰਿਹਾ ਮੈਨੂੰ ਜਾਣਕਾਰੀ ਦਿੱਤੀ ਜਾਵੇ ਇਹ ਜਾਣਕਾਰੀ ਤੁਸੀਂ ਮੈਨੂੰ ਈਮੇਲ 'ਤੇ ਵੀ ਸੈਂਡ ਕਰ ਸਕਦੇ ਹੋ ਮੇਰੀ ਈਮੇਲ ਹੈ ਊੜਾ ਆੜਾ ਈੜੀ ਐਟ ਦਾ ਰੇਟ ਜੀਮੇਲ ਡੋਟ ਕੋਮ